ਦੇਖੋ ਇਹ ਤਾਂ ਫਸਲ 'ਤੇ ਨਿਰਭਰ ਕਰਦਾ ਹੈ ਜੇ ਤੁਸੀਂ ਕਣਕ ਜਾਂ ਝੋਨਾ ਵਰਗੀਆਂ ਆਮ ਫਸਲਾਂ ਦੀ ਗੱਲ ਕਰ ਰਹੇ ਹੋ ਤਾਂ ਆਪਣੀ ਸਥਾਨਕ ਮੰਡੀ 'ਚ ਵੇਚਣਾ ਸਭ ਤੋਂ ਸੌਖਾ ਤਰੀਕਾ ਹੈ ਹਰ ਸ਼ਹਿਰ ਜਾਂ ਕਸਬੇ 'ਚ ਇੱਕ ਦਾਣਾ ਮੰਡੀ ਹੁੰਦੀ ਹੈ ਜਿੱਥੇ ਤੁਸੀਂ ਆਪਣਾ ਫਸਲ ਵੇਚ ਸਕਦੇ ਹੋ ਜੇ ਤੁਸੀਂ ਕੋਈ ਖ਼ਾਸ ਫਸਲ ਉਗਾ ਰਹੇ ਹੋ ਜਿਵੇਂ ਕਿ ਸਬਜ਼ੀਆਂ ਜਾਂ ਫਲ ਤਾਂ ਤੁਹਾਨੂੰ ਥੋੜ੍ਹਾ ਹੋਰ ਖੋਜ ਕਰਨੀ ਪਵੇਗੀ ਤੁਸੀਂ ਸਿੱਧੇ ਵੱਡੇ ਸ਼ਹਿਰਾਂ ਦੀਆਂ ਮੰਡੀਆਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਕਿਸੇ ਕੰਪਨੀ ਨਾਲ ਗੱਲ ਕਰ ਸਕਦੇ ਹੋ ਜੋ ਇਹ ਚੀਜ਼ਾਂ ਖਰੀਦਦੀਆਂ ਹਨ ਦੂਜੇ ਸੂਬਿਆਂ 'ਚ ਵੇਚਣ ਲਈ ਤੁਹਾਨੂੰ ਟਰਾਂਸਪੋਰਟੇਸ਼ਨ ਦਾ ਖਿਆਲ ਰੱਖਣਾ ਪਵੇਗਾ ਕੁਝ ਫਸਲਾਂ ਜਲਦੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਨੂੰ ਛੇਤੀ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ ਸਰਕਾਰ ਦੇ ਨਿਯਮਾਂ ਬਾਰੇ ਜਾਨਣ ਲਈ ਤੁਸੀਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਉਹ ਤੁਹਾਨੂੰ ਦੱਸ ਸਕਦੇ ਹਨ ਕਿ ਕਿਸ ਫਸਲ ਨੂੰ ਕਿਵੇਂ ਵੇਚਣਾ ਹੈ ਅਤੇ ਕਿਹੜੇ ਕਾਗਜ਼ਾਂ ਦੀ ਜ਼ਰੂਰਤ ਹੋਵੇਗੀ ਵਿਚੋਲੇ ਵਪਾਰੀ ਵੀ ਹੁੰਦੇ ਹਨ ਜੋ ਕਿਸਾਨਾਂ ਤੋਂ ਫਸਲਾਂ ਖਰੀਦ ਕੇ ਅੱਗੇ ਵੇਚਦੇ ਹਨ ਪਰ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਹਾਨੂੰ ਸਹੀ ਕੀਮਤ ਮਿਲ ਰਹੀ ਹੈ ਜਾਂ ਨਹੀਂ ਕਈ ਵਾਰ ਵਿਚੋਲੇ ਆਪਣਾ ਕਮਿਸ਼ਨ ਬਹੁਤ ਜ਼ਿਆਦਾ ਰੱਖ ਲੈਂਦੇ ਹਨ ਸੋ ਮੇਰਾ ਖਿਆਲ ਹੈ ਕਿ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਫਸਲ ਬਾਰੇ ਪੂਰੀ ਜਾਣਕਾਰੀ ਇਕੱਠੀ ਕਰੋ ਮਾਰਕੀਟ ਰਿਸਰਚ ਕਰੋ ਅਤੇ ਫਿਰ ਫਸਲ ਕਰੋ ਕਿ ਕਿਵੇਂ ਵੇਚਣਾ ਹੈ